ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਪਟਿਆਲਾ ਤੋਂ ਗੱਲ ਕਰ ਰਿਹਾ ਕੀ ਤੁਸੀਂ ਗੋਪਾਲ ਸਵੀਟ ਦੇ ਗੋਪਾਲ ਸਵੀਟ ਤੋਂ ਬੋਲ ਰਹੇ ਹੋ ਅਤੇ ਭਾਅ ਜੀ ਮੈਂ ਨਾ ਸਮਾਨ ਔਡਰ ਕਰਨਾ ਸੀ ਮੈਨੂੰ ਆਪਣੇ ਦੁਕਾਨ ਦਾ ਮਸ਼ਹੂਰ ਕੋਈ ਮਿੱਠੇ ਪਕਵਾਨਾਂ ਦੀ ਜਾਣਕਾਰੀ ਦਿਉ ਕਿ ਮੈਂ ਔਡਰ ਕਰ ਸਕਾਂ ਅਤੇ ਮੈਂ ਆਪਣੇ ਘਰਦਿਆਂ ਨੂੰ ਵੀ ਦੱਸ ਸਕਾਂ ਕਿ ਜੇ ਉਹਨਾਂ ਨੇ ਖਾਣਾ ਉਹ ਆਪਣੇ ਹਿਸਾਬ ਨਾਲ ਔਡਰ ਕਰ ਸਕਣ ਅੱਛਾ ਜੀ ਆਹ ਤੁਹਾਡੇ ਸ ਜੋ ਵੀ ਹੈ ਤੁਹਾਡਾ ਇਹ ਫੇਮਸ ਹੈ ਜੀ ਅਤੇ ਇਹ ਨਾ ਸਾਰਾ ਮੈਨੂੰ ਪੈਕ ਕਰਕੇ ਔਡਰ ਕਰ ਦਿਉ ਅਤੇ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਕਰ ਦਿੰਦਾ ਅਤੇ ਬਾਕੀ ਮੈਨੂੰ ਨਾ ਕੋਈ ਮਸਾਲੇਦਾਰ ਚੀਜ਼ ਬਾਰੇ ਵੀ ਜਾਣਕਾਰੀ ਦਿਉ ਜਿਹੜੀ ਤੁਹਾਡੇ ਸ਼ੋਪ ਦੀ ਬਹੁਤ ਫੇਮਸ ਹੈ ਅਤੇ ਮੈਂ ਬੀਕੋਸ ਮੈਂ ਨਾ ਮਸਾਲੇਦਾਰ ਚੀਜ਼ਾਂ ਦਾ ਸ਼ੌਕੀਨ ਹਾਂ ਅਤੇ ਮਿੱਠਾ ਮੇਰੇ ਘਰਦੇ ਖਾਂਦੇ ਨੇ ਮੈਂ ਇੰਨਾ ਖਾਂਦਾ ਨਹੀਂ ਅੱਛਾ ਜੀ ਤੁਹਾਡੇ ਇੱਥੇ ਅੰਬਰਸਰੀ ਕੁਲਚੇ ਮਸ਼ਹੂਰ ਨੇ ਚਲੋ ਉਹ ਭੇਜ ਦਿਉ ਜੀ ਕੋਈ ਨਹੀਂ ਜੇ ਤੁਹਾਡਾ ਮਟੀਰੀਅਲ ਸਾਨੂੰ ਵਧੀਆ ਲੱਗਾ ਅਸੀਂ ਤੁਹਾਡੇ ਤੋਂ ਨਾ ਬ੍ਰਦਰ ਦਾ ਵਿਆਹ ਆ ਰਿਹਾ ਅਤੇ ਉੱਥੇ ਕੈਟਰਿੰਗ ਵੀ ਤੁਹਾਡੇ ਤੋਂ ਹੀ ਕਰਾਵਾਂਗੇ ਔਡਰ ਪੂਰਾ ਤੁਹਾਨੂੰ ਦੇਵਾਂਗੇ ਵਧੀਆ ਔਡਰ ਦੇਵਾਂਗੇ ਨਾਲ ਆਪਣਾ ਭਾਈਚਾਰਾ ਵਧੇਗਾ ਜੀ ਪੰਜਾਬੀ ਬੰਦੇ ਪੰਜਾਬੀ ਬੰਦੇ ਦੇ ਕੰਮ ਆਉਂਦਾ ਜੀ ਨਾਲ ਪੰਜਾਬੀਆਂ ਦਾ ਤੁਹਾਨੂੰ ਪਤਾ ਜੀ ਸੁਭਾਅ ਖੁੱਲ੍ਹਾ ਜੀ ਖਾਣ ਵਾਲੇ ਖ ਦ ਖੁੱਲ੍ਹੇ ਦਿਲ ਨਾਲ ਖਾਂਦੇ ਨੇ ਜੀ ਖੁੱਲ੍ਹੇ ਦਿਲ ਨਾਲ ਉਡਾਉਂਦੇ ਨੇ ਚਲੋ ਵਧੀਆ ਜੀ ਅਤੇ ਸ਼ੋਪ ਬਹੁਤ ਮਸ਼ਹੂਰ ਆ ਮੈਂ ਨਾਮ ਸੁਣਿਆ ਸੀ ਮੈਂ ਤਾਂ ਕਰਕੇ ਮੈਨੂੰ ਮੇਰੇ ਨਾਲ ਦਿਆਂ ਨੇ ਕਿਹਾ ਕਿ ਭਾਅ ਜੀ ਤੋਂ ਔਡਰ ਕਰਿਆ ਕਰੋ ਸਮਾਨ ਬਹੁਤ ਵਧੀਆ ਅਤੇ ਸਾਫ ਸੁਥਰਾ ਸਮਾਨ ਬਣਾਉਂਦੇ ਨੇ ਅਤੇ ਇਹਨਾਂ ਦੇ ਸਾਰਾ ਉਹ ਫੋਰਨ ਕੰਟਰੀ 'ਚ ਵੀ ਇਹਨਾਂ ਦਾ ਸਮਾਨ ਜਾਂਦਾ ਅਸਪੋਟ ਹੁੰਦਾ ਮੈਂ ਚਲੋ ਵਧੀਆ ਜੀ ਕੋਈ ਨਹੀਂ ਅਤੇ ਚਲੋ ਓਕੇ ਭਾਅ ਜੀ ਭੇਜ ਦਿਉ ਔਡਰ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਕਰਦਾ ਬਿੱਲ ਕਰ ਦਿਉ ਜੀ ਓਕੇ ਬਾਏ ਸਤਿ ਸ਼੍ਰੀ ਅਕਾਲ ਭਾਅ ਜੀ